ਵਿਕਾਸਸ਼ੀਲ ਸੰਸਾਰ ਬਾਰੇ ਮੇਰੇ ਬਹੁਤ ਵਿਚਾਰ ਹਨ ਕਿਉਂਕਿ ਦੁਨੀਆਂ ਬਹੁਤ ਬਦਲ ਗਈ ਹੈ ਕਿਉਂਕਿ ਪਹਿਲਾਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਬਹੁਤ ਸਮਾਂ ਲੱਗਦਾ ਸੀ ਅਤੇ ਹੁਣ ਬਹੁਤ ਕੁਛ ਚੇਂਜ ਹੋ ਗਿਆ ਹੈ ਹੁਣ ਇਹਨਾਂ ਆਵਾਜਾਈ ਦੇ ਸਾਧਨਾਂ ਕਾਰਨ ਕਿਉਂਕਿ ਹਰੇਕ ਕੋਲ ਆਪਣੇ ਆਪਣੇ ਸਾਧਨ ਹਨ ਤਾਂ ਉਸ ਕਾਰਨ ਬਹੁਤ ਘੱਟ ਸਮਾਂ ਲੱਗਦਾ ਹੈ ਅਤੇ ਇੰਟਰਨੈੱਟ ਕਾਰਨ ਦੁਨੀਆਂ ਬਹੁਤ ਅੱਗੇ ਵੱਧ ਚੁੱਕੀ ਹੈ ਭਾਵ ਕਿ ਦੁਨੀਆਂ ਬਦਲ ਗਈ ਹੈ